ਹਾਂਜੀ ਮਾਰਕੀਟਿੰਗ ਦਾ ਜੀ ਤੁਸੀਂ ਜਾਨੀ ਕਿ ਕਾਫ਼ੀ ਆਪਣਾ ਆਨਲਾਈਨ ਵੀ ਕਰ ਸਕਦੇ ਹੋ ਯਾਨੀ ਕਿ ਆਨਲਾਈਨ ਦਾ ਆਪਣਾ ਕੋਈ ਬੈਨਰ ਛਪਾ ਲਿਆ ਆਨਲਾਈਨ ਦਾ ਵੀ ਹੁੰਦਾ ਜੀ ਅਤੇ ਬੈਨਰ ਛਪਾ ਲਿਆ ਆਪਣਾ ਠੀਕ ਹੈ ਅਤੇ ਇੰਡੀਆ ਮਾਰਟ 'ਤੇ ਵੀ ਆਪਣਾ ਪਾ ਸਕਦੇ ਹਾਂ ਕਿ ਮੈਂ ਇਸ ਚੀਜ਼ ਦਾ ਕੰਮ ਕਰਦਾ ਹਾਂ ਮੈਂ ਇਸ ਚੀਜ਼ ਦੀ ਮਾਰਕੀਟਿੰਗ ਕਰਦਾ ਹਾਂ ਅਤੇ ਕਾਫ਼ੀ ਯਾਨੀ ਕਿ ਉੱਥੇ ਮਾਰਕਿਟਿੰਗਾਂ ਕੰਮ ਇਹ ਆ ਜੀ ਬਹੁਤ ਕਾਫ਼ੀ ਟਾਈਮ ਤੋਂ ਹੋ ਸਕਦਾ ਵਾ ਕਾਫ਼ੀ ਟਾਈਮ ਤੋਂ ਪਸੀਜਰ ਚੱਲ ਸਕਦਾ ਵਾ ਮਾਰਕੀਟਿੰਗ ਬਹੁਤ ਉਹ ਕਰਨਾ ਪੈਂਦਾ ਆਪਣੇ ਵਿਜਟਿੰਗ ਵਾਲਾ ਆਪਣੇ ਕਿਸੇ ਕਿ ਸ਼ੋਪ ਤੇ ਆਪਾਂ ਕਿਸੇ ਨੂੰ ਦੇ ਸਕਦੇ ਹਾਂ ਤਾਂ ਬਟ ਉਸ ਤੋਂ ਇਲਾਵਾ ਕਾਫ਼ੀ ਯਾਨੀ ਕਿ ਬਹੁਤ ਕੁਛ ਕਰਨਾ ਪੈਂਦਾ ਉਹਦੇ ਲਈ ਵਿਜਟਿੰਗ ਕਾਰਡ ਹੋ ਗਿਆ ਓਲੈਕਸ 'ਤੇ ਉਹ ਕਰਤਾ ਠੀਕ ਹੈ ਕਿਸ ਕੰਮ ਨੂੰ ਕੀ ਕੀ ਅਗੇ ਆਪਾਂ ਕਰਦੇ ਆਹਾਂ ਉਸ ਕੰਮ ਨੂੰ ਸਾਰਾ ਦੱਸਣਾ ਪੈਣਾ ਆਪਾਂ ਨੂੰ ਕੀ ਹੈਗਾ ਕੀ ਨਹੀਂ